ਅੱਜ ਦੇ ਯੁੱਗ ਵਿੱਚ ਨਵਜੰਮੇ ਬੱਚਿਆਂ ਨੂੰ ਸਾਫ ਸੁਥਰਾ ਵਾਤਾਵਰਨ ਦੇਣਾ ਬਹੁਤ ਹੀ ਚੁਣੌਤੀਪੂਰਨ ਹੈ ਕਿਉਂਕਿ ਆਪਾਂ ਦੇਖਦੇ ਹਾਂ ਕਿ ਹਰ ਕਿਉਂਕਿ ਤਕਨੀਕੀ ਯੁੱਗ ਹੈ ਤਕਨੀਕੀ ਯੁੱਗ ਦੇ ਵਿੱਚ ਆਉਣ ਨਾਲ ਨਵੇਂ ਆਹ ਟਾਵਰ ਲੱਗੇ ਹਨ ਜਿਹਨਾਂ ਵਿੱਚੋਂ ਰੈਡੀਏਸ਼ਨ ਹੈ ਦਰਖਤ ਕੱਟੇ ਜਾ ਰਹੇ ਹਨ ਹਾਈਵੇ ਬਣਾਉਣ ਦੇ ਲਈ ਥਾਂ ਥਾਂ 'ਤੇ ਫੈਕਟਰੀਆਂ ਹਨ ਧੂੰਆਂ ਹੈਗਾ ਅਤੇ ਇਸ ਦੇ ਵਿੱਚ ਨਵਜੰਮੇ ਬੱਚੇ ਨੂੰ ਜਿਹੜਾ ਸਵੱਛ ਵਾਤਾਵਰਨ ਦੇਣਾ ਉਹ ਬਹੁਤ ਹੀ ਜੋਖਿਮ ਭਰਿਆ ਹੋ ਜਾਂਦਾ ਹੈ ਜਾਂ ਚੁਣੌਤੀਪੂਰਨ ਆਪਾਂ ਕਹਿ ਸਕਦੇ ਹਾਂ ਜੋਖਿਮ ਭਰਿਆ ਆਪਾਂ ਨਹੀਂ ਕਹਿ ਸਕਦੇ ਚੁਣੌਤੀਪੂਰਨ ਹੋ ਜਾਂਦਾ ਹੈ ਕਿਉਂਕਿ ਜ਼ਿੰਦਗੀ ਚੁਣੌਤੀਆਂ ਨਾਲ ਜਿਹੜੀ ਲੱਦੀ ਪਈ ਹੁੰਦੀ ਹੈ ਤਾਂ ਇਸ ਵਿੱਚ ਜਦੋਂ ਬੱਚਾ ਜੰਮਦਾ ਹੈ ਸਭ ਤੋਂ ਪਹਿਲਾਂ ਤਾਂ ਸਿਰਫ ਉਸਦੀ ਮਾਂ ਨੂੰ ਜਾਂ ਪਿਤਾ ਨੂੰ ਹੀ ਅੰਦਰ ਆਉਣ ਦੀ ਆਗਿਆ ਹੋਣੀ ਚਾਹੀਦੀ ਹੈ ਹੋਰ ਤੀਜਾ ਪਰਸਨ ਕਿਸੇ ਨੂੰ ਅੰਦਰ ਆਉਣ ਦੀ ਆਗਿਆ ਨਹੀਂ ਹੋਣੀ ਚਾਹੀਦੀ ਬੱਚੇ ਨੂੰ ਜਿਹੜੀ ਹੈਗੀ ਆ ਵੀ ਉਸ ਨੂੰ ਬਾਹਰ ਨਹੀਂ ਕੱਢਣਾ ਚਾਹੀਦਾ ਘਰ ਦੇ ਵਿੱਚੋਂ ਉਸ ਨੂੰ ਜੇਕਰ ਹੋਸਪਿਟਲ ਤੋਂ ਘਰ ਵੀ ਲੈ ਕੇ ਆਉਣਾ ਚਾਹੀਦਾ ਹੈ ਤਾਂ ਸਿਰਫ ਗੱਡੀ ਵਿੱਚ ਦੋ ਜਾਂ ਤਿੰਨ ਜਣਿਆਂ ਤੋਂ ਵੱਧ ਨਾ ਹੋਣ ਅਤੇ ਉਸ ਤੋਂ ਇਲਾਵਾ ਬੱਚੇ ਨੂੰ ਇੱਕ ਅਜਿਹੇ ਇਨਵਾਇਰਮੈਂਟ 'ਚ ਰੱਖਣਾ ਚਾਹੀਦਾ ਹੈ ਜਿੱਥੇ ਕਮਰਾ ਸਾਫ ਸੁਥਰਾ ਹੋਵੇ ਜਿੱਥੋਂ ਦੀ ਹਵਾ ਪਿਓਰ ਹੋਵੇ ਜਿੱਥੇ ਸਨਲਾਈਟ ਵੀ ਆਉਂਦੀ ਹੋਵੇ ਕਿਉਂਕਿ ਜਿਹੜੀ ਧੁੱਪ ਆ ਧੁੱਪ ਨਵਜੰਮੇ ਬੱਚੇ ਦੇ ਅੱਖਾਂ ਲਈ ਤਾਂ ਮਾੜੀ ਹੈ ਪਰ ਉਹਦੇ ਜਿਹੜੀ ਸਰੀਰ ਦੇ ਲਈ ਆ ਉਹ ਬਹੁਤ ਹੀ ਮਹੱਤਵਪੂਰਨ ਹੈ ਚੜ੍ਹਦੀ ਧੁੱਪ 'ਚ ਠੀਕ ਹੈ ਨਾ ਕਿਉਂਕਿ ਉਸਦੇ ਵਿੱਚ ਆਪਾਂ ਨੂੰ ਵਿਟਾਮਿਨ ਡੀ ਮਿਲਦਾ ਹੈ

ਇਸ ਚੀਜ਼ ਦਾ ਖਾਮਿਆਜ਼ਾ ਵੀ ਭੁਗਤਣਾ ਪੈ ਸਕਦਾ ਹੈ ਸੋ ਨਵਜੰਮੇ ਬੱਚੇ ਨੂੰ ਬਹੁਤ ਹੀ ਕੇਅਰ ਦੀ ਲੋੜ ਹੁੰਦੀ ਹੈ ਬਹੁਤ ਹੀ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਜਦੋਂ ਬੱਚਾ ਮਹੀਨਾ ਜਾਂ ਸਵਾ ਮਹੀਨੇ ਦਾ ਹੁੰਦਾ ਹੈ ਤਾਂ ਉਸ ਨੂੰ ਬਾਹਰ ਕੱਢਣਾ ਚਾਹੀਦਾ ਹੈ ਉਸ ਤੋਂ ਪਹਿਲਾਂ ਨਹੀਂ